ਮਨਪਸੰਦ ਮਨਪਸੰਦ ਤਾਂ ਬਹੁਤ ਕੁਛ ਹੈ ਗੋਲ ਗੱਪੇ ਪੀਜ਼ਾ ਬਰਗਰ ਫਾਸਟ ਫੂਡ ਇੰਨਾ ਵਧੀਆ ਲੱਗਦਾ ਜਿੰਨਾ ਮਰਜ਼ੀ ਖਵਾ ਲਓ ਪਰ ਸਭ ਤੋਂ ਬੈਸਟ ਸਭ ਤੋਂ ਬੈਸਟ ਖੀਰ ਐਨੀ ਟੇਸਟੀ ਲੱਗਦੀ ਐਨੀ ਟੇਸਟੀ ਲੱਗਦੀ ਆ ਕਿਉਂਕਿ ਉਹਦੇ ਵਿੱਚ ਦੁੱਧ ਪਾਇਆ ਹੁੰਦਾ ਉਹਦੇ ਵਿੱਚ ਕਿਸ਼ਮਿਸ਼ ਪਾਈ ਹੁੰਦੀ ਆ ਬਦਾਮ ਪਾਏ ਹੁੰਦੇ ਆ ਕਾਜੂ ਪਾਇਆ ਹੁੰਦਾ ਐਨਾ ਮਜ਼ਾ ਆਉਂਦਾ ਹੈ ਨਾ ਖੀਰ ਖਾਣ 'ਤੇ ਤਾਂ ਬਹੁਤ ਜ਼ਿਆਦਾ ਮਜ਼ਾ ਆਉਂਦਾ ਐਨੀ ਸਵਾਦਿਸ਼ਟ ਬਣਦੀ ਹੈ ਖੀਰ ਖੀਰ ਮੇਰੀ ਫੇਵਰਟ ਹੈ ਅਤੇ ਮਨਪਸੰਦ ਹੈ ਇੰਨੀ ਮਨਪਸੰਦ ਹੈ ਪੁੱਛੋ ਹੀ ਨਾ ਇੰਨੀ ਮਨਪਸੰਦ ਹੈ ਹੋਰ ਬਥੇਰਾ ਕੁਛ ਹੈ ਖਾਣ ਪੀਣ ਨੂੰ ਪਰ ਖੀਰ ਜ਼ਿਆਦਾ ਚੰਗੀ ਲੱਗਦੀ ਹੈ ਖਾਣ ਨੂੰ ਮੈਨੂੰ ਕਿਉਂਕਿ ਇਹ ਸਿਹਤ ਲਈ ਵੀ ਚੰਗੀ ਹੈ ਅਤੇ ਸਰੀਰ ਲਈ ਵੀ ਚੰਗੀ ਇਸ ਲਈ ਖੀਰ ਸਭ ਤੋਂ ਵਧੀਆ ਅਤੇ ਚੰਗਾ ਭੋਜਨ ਹੈ ਮੇਰੇ ਲਈ